ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਮਾਨ ਸਿੰਘ ਨੰਗਲ਼ ਦਾ ਰਹਿਣ ਵਾਲਾ ਹਾਂ ਇੱਕ ਹਫ ਇੱਕ ਹਫਤੇ ਪਹਿਲਾਂ ਮੈਂ ਇੱਕ ਮੋਬਾਇਲ ਦਾ ਚਾਰਜਰ ਔਡਰ ਕੀਤਾ ਸੀ ਜੋ ਕਿ ਉਹ ਅੱਜ ਮੇਰੇ ਕੋਲ ਪਹੁੰਚ ਚੁੱਕਿਆ ਹੈ ਪਰ ਮੈਂ ਉਹ ਚਾਰਜਰ ਲੈਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਚਾਰਜਰ ਸ਼ੋਪ ਤੋਂ ਜਾ ਕੇ ਖਰੀਦ ਲਿਆ ਸੀ ਤਾਂ ਕਿਰਪਾ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿ ਉਹ ਚਾਰਜ ਨੂੰ ਤੁਸੀਂ ਵਾਪਸ ਕਰ ਸਕਦੇ ਹੋ ਜੇਕਰ ਤੁਸੀਂ ਉਸ ਚਾਰਜਰ ਨੂੰ ਵਾਪਸ ਕਰ ਸਕਦੇ ਹੋ ਤਾਂ ਮੈਨੂੰ ਦੱਸ ਦਿਓ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ